ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਹੀ ਸ਼ੌਂਕ ਹੈ ਅਤੇ ਮੈਂ ਹਰ ਰੋਜ਼ ਇਹੀ ਸੋਚਦਾ ਹਾਂ ਕਿ ਮੈਂ ਵੱਖ ਵੱਖ ਕਿਤਾਬਾਂ ਪੜ੍ਹਾਂ ਮੈਂ ਰਾਤ ਨੂੰ ਸੋਣ ਤੋਂ ਪਹਿਲਾਂ ਰੋਜ਼ ਹੀ ਕਿਤਾਬ ਪੜ੍ਹਦਾ ਹਾਂ ਇਸ ਕਰਕੇ ਇਸ ਕਰਕੇ ਮੈਂ ਮੈਂ ਮੈਨੂੰ ਹਮੇਸ਼ਾਂ ਕਿਤਾਬਾਂ ਤੋਂ ਕੁਝ ਨਾ ਕੁਝ ਨੌਲੇਜ ਮਿਲਦੀ ਹੀ ਰਹਿੰਦੀ ਹੈ ਵੱਖ ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਹਾਂ ਜੇਕਰ ਮੈਨੂੰ ਮੌਕਾ ਮਿਲੇ ਤਾਂ ਮੈਂ ਅਲੱਗ ਅਲੱਗ ਤਰ੍ਹਾਂ ਦੀਆਂ ਲੋਅ ਦੀਆਂ ਕਿਤਾਬਾਂ ਪੜ੍ਹਾਂਗਾ ਜਿਸ ਤੋਂ ਮੈਨੂੰ ਬਹੁਤ ਹੀ ਜ਼ਿਆਦਾ ਨੌਲੇਜ ਮਿਲਦੀ ਹੈ ਨੌਲੇਜ ਮਿਲਦੀ ਅਤੇ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਹੈ ਮੈਨੂੰ ਕਿਤਾਬਾਂ ਪੜ੍ਹਨ ਨਾਲ ਮੈਨੂੰ ਕਿਤਾਬਾਂ ਪੜ੍ਹਨ ਨਾਲ਼ ਦਿਮਾਗ਼ ਬਹੁਤ ਤੇਜ਼ ਹੁੰਦਾ ਹੈ ਅਤੇ ਅਲੱਗ ਅਲੱਗ ਚੀਜ਼ਾਂ ਬਾਰੇ ਪਤਾ ਲੱਗਦਾ ਹੈ ਜਿਵੇਂ ਕਿ ਮੈਂ ਹਾਲ ਹੀ ਵਿੱਚ ਇੱਕ ਅਮੈਰੀਕਾ ਦੀ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਹੈ ਦੀ ਸਟੋਕ ਮਾਰਕੀਟ ਅਤੇ ਉਸ ਨਾਲ਼ ਮੈਨੂੰ ਸਟੋਕ ਮਾਰਕੀਟ ਬਾਰੇ ਬਹੁਤ ਹੀ ਕੁਝ ਅਲੱਗ ਅਲੱਗ ਪਤਾ ਲੱਗਾ ਹੈ ਕਿ ਅਸੀਂ ਆਪਣੇ ਪੈਸੇ ਨੂੰ ਕਿਸ ਤਰ੍ਹਾਂ ਬਣਾ ਸਕਦੇ ਹਾਂ ਅਤੇ ਕਿਸ ਤਰ੍ਹਾਂ ਵੱਧ ਤੋਂ ਵੱਧ ਪੈਸਾ ਕਮਾ ਸਕਦੇ ਹਾਂ ਇਸ ਇਸ ਦੇ ਨਾਲ਼ ਮੈਨੂੰ ਬਹੁਤ ਹੀ ਪ੍ਰੇਰਨਾ ਮਿਲਦੀ ਹੈ